ਅੱਜ ਕੱਲ੍ਹ ਦਾ ਸਮਾਂ ਟੈਕਨੋਲੋਜੀ ਦਾ ਸਮਾਂ ਹੈ ਡਿਜੀਟਲ ਸਮਾਂ ਹੈ ਵਿਗਿਆਨ ਦਾ ਸਮਾਂ ਹੈ ਅਤੇ ਸਮਾਰਟਫੋਨ ਇੱਕ ਸਾਰਿਆਂ ਵਾਸਤੇ ਇੱਕ ਅਹਿਮੀਅਤ ਬਣ ਚੁੱਕਾ ਹੈ ਜੇ ਮੈਂ ਕੋਈ ਨਵਾਂ ਸਮਾਰਟਫਾਨ ਲੈਣਾ ਹੋਵੇ ਸਮਾਰਟਫੋਨ ਵਿੱਚ ਬਹੁਤ ਸਾਰੇ ਇੱਦਾਂ ਦੀ ਫੀਚਰ ਆਉਂਦੇ ਹਨ ਜਿਹੜੇ ਮੈਨੂੰ ਪਸੰਦ ਹੁੰਦੇ ਹਨ ਅਤੇ ਅੱਜ ਕੱਲ੍ਹ ਦੇ ਟਾਈਮ ਵਿੱਚ ਸਮਾਰਟਫੋਨ ਇੰਨਾ ਜ਼ਿਆਦਾ ਐਡਵਾਂਸ ਹੋ ਚੁੱਕਿਆ ਹੈ ਜ ਕਿ ਉਹ ਕੁਝ ਵੀ ਕਰ ਸਕਦਾ ਹੈ ਉਹਦੇ ਵਿੱਚ ਇੰਨੀਆਂ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਹਨ ਇੰਨੀਆਂ ਸਾਰੀਆਂ ਕਾਬਲੀਅਤ ਹੁੰਦੀਆਂ ਹਨ ਕਿ ਤੁਹਾਨੂੰ ਅੱਜ ਅੱਜ ਕੋਈ ਪੇਪਰ ਕੈਰੀ ਕਰਨ ਦੀ ਕੋਈ ਲੋੜ ਨਹੀਂ ਹੈ ਕੋਈ ਕਿਤਾਬ ਕੈਰੀ ਕਰਨ ਦੀ ਲੋੜ ਨਹੀਂ ਹੈ ਉਹ ਤੁਹਾਡੇ ਸਾਹਮਣੇ ਹੀ ਨਾਲ ਹੀ ਤੁਸੀਂ ਲੈ ਕੇ ਜਾ ਸਕਦੇ ਹੋ ਉਹ ਉਹਨੂੰ ਜਿਹਨੂੰ ਅਸੀਂ ਸੋਫਟ ਕੋਪੀ ਕਹਿੰਦੇ ਹਾਂ ਅਸੀਂ ਸਮਾਰਟਫੋਨ ਕਾਫੀ ਕੁਛ ਕਰ ਸਕਦਾ ਹੈ ਓਨਲਾਈਨ ਪੇਮੈਂਟ ਵੀ ਕਰ ਸਕਦਾ ਹੈ ਤੁਹਾਡੀ ਡਿਜੀਟਲ ਵੋਲਟ ਤੁਹਾਡੇ ਫੋਨ 'ਚ ਤੁਹਾਡੇ ਹੱਥ 'ਚ ਹੈਗਾ ਤੁਹਾਨੂੰ ਲੱਖਾਂ ਰੁਪਏ ਤ ਤੁਹਾਨੂੰ ਜੇਬ 'ਚ ਪਾ ਕੇ ਲੈ ਕੇ ਜਾਣ ਦੀ ਕੋਈ ਲੋੜ ਹੈ ਨਹੀਂ ਉਹ ਸਾਰੇ ਦਾ ਸਾਰਾ ਕੰਮ ਤੁਹਾਡਾ ਸਮਾਰਟਫੋਨ ਕਰ ਸਕਦਾ ਹੈ ਜੇ ਮੈਂ ਅੱਜ ਦੇ ਟਾਈਮ 'ਤੇ ਕੋਈ ਨਾ ਸਮਾਰਟਫੋਨ ਲੈਣਾ ਹੋਵੇ ਮੈਂ ਉਹਨੂੰ ਦੇਖਾਂਗਾ ਕਿ ਸਭ ਤੋਂ ਵਧੀਆ ਉਹਦੀ ਪ੍ਰੋਸੈਸਿੰਗ ਪਾਵਰ ਕੀ ਹੈ ਉਹਦਾ ਪ੍ਰੋਸੈਸਰ ਕਿਹੋ ਜਿਹਾ ਹੈਗਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿੱਥੇ ਸਾਨੂੰ ਸਪੀਡ ਚਾਹੀਦੀ ਆ ਤੇਜ਼ ਅਤੇ ਉਹ ਇੰਟਰਨੈਟ ਦੀ ਸਪੀਡ ਕਨੈਕਟੀਵਿਟੀ ਵਧੀਆ ਹੋਵੇਗੀ ਜੇ ਸਾਡੇ ਪ੍ਰੋਗਰਾਮ ਛੇਤੀ ਰਨ ਕਰਨਗੇ ਤਾਂ ਸਮਾਰਟਫੋਨ ਵਧੀਆ ਰੈਂਡ ਕਰੇਗਾ ਇਹਦੇ ਨਾਲ ਦੇ ਨਾਲ ਮੈਂ ਕਿਉਂਕਿ ਮੈਂ ਫਿਲਮ ਮੇਕਰ ਹੈਗਾ ਮੈਨੂੰ ਵੀਡੀਓ ਤਾਂ ਫੋਟੋਸ ਖਿੱਚਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਕੈਮਰਾ ਬਿਲਕੁਲ ਦੇਖਾਂਗਾ ਕੈਮਰਾ ਵਧੀਆ ਹੋਣਾ ਬਹੁਤ ਹੀ ਜ਼ਰੂਰੀ ਹੈ ਸਮਾਰਟਫੋਨ ਦੇ ਵਿੱਚ ਅਤੇ ਵਧੀਆ ਕੈਮਰਾ ਵਧੀਆ ਸਟੋਰੇਜ ਸਪੇਸ ਜਿਹਨੂੰ ਅਸੀਂ ਮੈਮਰੀ ਵੀ ਕਹਿੰਦੇ ਹਾਂ ਭਾਵੇਂ ਉਹ ਇੰਗਲਿਸ਼ 'ਚ ਕਹੋ ਭਾਵੇਂ ਪੰਜਾਬੀ 'ਚ ਕਹੋ ਇਹ ਸਟੋਰੇਜ ਸਪੇਸ ਇੱਕ ਸਮਾਰਟਫੋਨ ਦੇ ਵਿੱਚ ਚੀਜ਼ਾਂ ਕੈਰੀ ਕਰਨ ਦੀ ਬਹੁਤ ਹੀ ਵਧੀਆ ਇੱਕ ਅਹਿਮੀਅਤ ਬਣਦੀ ਹੈ ਜੇ ਮੈਂ ਓਨਲਾਈਨ ਆਫਲਾਈਨ 'ਤੇ ਸ਼ੋਪਿੰਗ ਵੀ ਕਰਨੀ ਹੋਵੇ ਅੱਜ ਕੱਲ੍ਹ ਸਮਾਰਟਫੋਨ ਉਹ ਵੀ ਬਹੁਤ ਹੀ ਜ਼ਿਆਦਾ ਉੱਤੋਂ ਆਸਾਨ ਬਣਾ ਦਿੰਦਾ ਹੈ ਅਤੇ ਜਿਹੜੀਆਂ ਚੀਜ਼ਾਂ ਮੈਂ ਮੈਂ ਉਦਾਂ ਅ ਆਪਣਾ ਓਨਲਾਈਨ ਸ਼ੋਪਿੰਗ ਔਫਲਾਈਨ ਸ਼ੋਪਿੰਗ ਕਰਨਾ ਜ਼ਿਆਦਾ ਪਸੰਦ ਕਰਦਾ ਹਾਂ ਓਨਲਾਈਨ ਸ਼ੋਪਿੰਗ ਵੀ ਮੈਂ ਕਰਦਾ ਹਾਂ ਮੈਂ ਜਿੱਥੇ ਮੈਨੂੰ ਔਨ ਓਫਲਾਈਨ ਚੀਜ਼ ਨਹੀਂ ਮਿਲਦੀ ਹੈ ਜੇ ਬਹੁਤ ਦੂਰ ਜਾਣਾ ਪਵੇ ਕਿਉਂਕਿ ਮੈਂ ਜਲੰਧਰ ਦਾ ਰਹਿਣ ਵਾਲਾ ਨਾਗਰਿਕ ਹਾਂ ਬਟ ਜਿਹੜੀ ਚੀਜ਼ ਮੈਨੂੰ ਦਿੱਲੀ 'ਚ ਅਵੇਲੇਬਲ ਹੈਗੀ ਆ ਉਹ ਬਾਕੀ ਜਗ੍ਹਾ ਮੌਜੂਦ ਹੀ ਨਹੀਂ ਅਤੇ ਮੈਨੂੰ ਇੰਨੀ ਦੂਰ ਸਫਰ ਕਰਨਾ ਔਖਾ ਲੱਗਦਾ ਹੈ ਉਦੋਂ ਮੈਂ ਓਨਲਾਈਨ ਸ਼ੋਪਿੰਗ ਪ੍ਰੈਫਰ ਕਰਦਾ ਹਾਂ